ਪੰਜਾਬ ਵਿੱਚ ਕਬੱਡੀ ਕੱਪ ਸਭ ਤੋਂ ਵੱਧ ਵੱਡਾ ਟੂਰਨਾਮੈਂਟ ਹੈ ਜਿਹਨੂੰ ਆਯੋਜਿਤ ਕੀਤਾ ਜਾਂਦਾ ਹੈ ਜਿਸ ਨਾਲ਼ ਰਾਜਾਂ ਨਾਲ਼ ਮਜ਼ਬੂਤ ਸੰਬੰਧ ਬਣਦੇ ਹੈ ਜਿਵੇਂ ਕਿ ਪਿੱਛੇ ਜਿਹੇ ਅਕਾਲੀ ਸਰਕਾਰ ਵੱਲੋਂ ਕਬੱਡੀ ਕੱਪ ਚਲਾਇਆ ਗਿਆ ਸੀ ਜਿਸ ਵਿੱਚ ਦੂਰੋਂ ਦੂਰੋਂ ਅ ਬ ਦੂਰ ਦੂਰ ਵਾਲੀਆਂ ਕੰਨਟ ਕੰਨਟਰੀਆਂ ਨੇ ਹਿੱਸਾ ਲਿਆ ਸੀ ਜਿਵੇਂ ਕਿ ਪਾਕਿਸਤਾਨ ਰਸ਼ੀਆ ਅਫਗਾਨਿਸਤਾਨ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ ਇਸ ਤਰ੍ਹਾਂ ਦੇ ਟੂਰਨਾਮੈਂਟ ਕਰਾਉਣੇ ਚਾਹੀਦੇ ਹਨ